ਹਾਂਜੀ ਸਤਿ ਸ਼੍ਰੀ ਅਕਾਲ ਸਰ ਸਰ ਕਿਵੇਂ ਹੋ ਤੁਸੀਂ ਸਰ ਤੁਸੀਂ ਟੇ ਢਿੱਲੋਂ ਏਜੰਸੀ ਤੋਂ ਬੋਲ ਰਹੇ ਹਾਂ ਗੱਲ ਕਰ ਰਹੇ ਹਾਂ ਸਰ ਮੈਂ ਤੁਹਾਡੀ ਰੈਗੂਲਰ ਕਸਟਮਰ ਗੱਲ ਕਰਦੀ ਹਾਂ ਤੁਹਾਡੇ ਨਾਲ਼ ਸਰ ਜਿੱਦਾਂ ਹੁਣ ਛੁੱਟੀਆਂ ਹੋਈਆਂ ਹੋਈਆਂ ਆ ਅਤੇ ਯਾਤਰਾ ਲਈ ਅਸੀਂ ਜਾਣਾ ਸੀਗਾ ਤੁਹਾਡੀ ਕੈਬ ਬੁੱਕ ਕਰਨੀ ਸੀਗੀ ਅਤੇ ਜੇ ਸਾਨੂੰ ਡਿਸਕਾਊਂਟ ਕੀ ਕਿੰਨਾਂ ਕਿਰਾਇਆ ਲਊਂਗੇ ਤੁਸੀਂ ਸਾਡੇ ਤੋਂ ਜੇ ਤੁਸੀਂ ਅਸੀਂ ਤੁਹਾਡੇ ਰੈਗੁਲਰ ਕਸਟਮਰ ਹਾਂ ਤਾਂ ਥੋੜ੍ਹੀ ਬਹੁਤ ਡਿਸਕਾਊਂਟ ਕਰ ਦੇਵੋਗੇ ਤਾਂ ਸਰ ਤੁਹਾਡੀ ਕੈਬ ਬੁੱਕ ਕਰਨੀ ਆ ਅਸੀਂ ਸਰ ਯਾਤਰਾ 'ਤੇ ਜਾਣਾ ਨਾ ਤਾਂ ਕਰਕੇ ਸਰ ਸਰ ਪਲੀਸ ਸਾਨੂੰ ਡਿਸਕਾਊਂਟ ਦੇ ਦਿਓ ਧੰਨਵਾਦ ਸਰ